ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੋਨੀਕਾ ਮੈਂ ਗੁਰਦਾਸਪੁਰ ਪੰਜਾਬ ਵਿੱਚ ਰਹਿਣ ਵਾਲੀ ਹਾਂ ਜਿੱਥੇ ਕਿ ਮਤਲਬ ਕਿ ਪੰਜਾਬੀ ਨੂੰ ਬੜਾ ਮਹੱਤਵ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਅਸੀਂ ਇੱਕ ਐਨ ਜੀ ਓ 'ਚ ਕੰਮ ਕਰਦੇ ਹਾਂ ਜਿਹਦੇ ਵਿੱਚ ਅਸੀਂ ਕਾਫੀ ਮੀਟਿੰਗਾਂ ਕਰਦੇ ਹਾਂ ਮਤਲਬ ਕਿ ਇੱਕ ਅਸੀਂ ਆਨਲਾਈਨ ਮੀਟਿੰਗ ਲਗਾਉਂਦੇ ਹਾਂ ਉਹ ਵੀ ਸਾਡੇ ਪੰਜਾਬੀ 'ਚ ਹੀ ਲੱਗਦੀ ਹੈ ਅਤੇ ਮਤਲਬ ਕਿ ਕਈ ਮਤਲਬ ਕਿ ਕਈ ਇਹੋ ਜਿਹੇ ਕੰਮ ਹੈ ਜਿੱਦਾਂ ਕਿ ਅਸੀਂ ਕਚਹਿਰੀ ਵਿੱਚ ਜਾਣਾ ਕੋਈ ਵੀ ਕੰਮ ਕਰਨਾ ਮਤਲਬ ਕਿ ਮਤਲਬ ਕਿ ਲੋਕਾਂ ਦੇ ਫੋਰਮ ਵਗੈਰਾ ਫਿਲ ਕਰਦੇ ਹਾਂ ਉਹ ਵੀ ਅਸੀਂ ਪੰਜਾਬੀ 'ਚ ਕਰਦੇ ਹਾਂ ਜਿਸ ਤਰ੍ਹਾਂ ਮਤਲਬ ਕਿ ਅਸੀਂ ਕਈ ਉਹ ਜਿਹੇ ਮਤਲਬ ਕਿ ਬੱਚੇ ਵ ਆਪਣੇ ਬੱਚਿਆਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਪੰਜਾਬੀ ਹੀ ਸਿਖਾਈ ਹੈ ਅਤੇ ਅਸੀਂ ਬੱਚਿਆਂ ਨੂੰ ਇੰਗਲਿਸ਼ ਵਗੈਰਾ ਜਾਂ ਹਿੰਦੀ ਵਗੈਰਾ ਵੀ ਆਉਂਦੀ ਹੈ ਪਰ ਜ਼ਿਆਦਾਤਰ ਬੱਚੇ ਪੰਜਾਬੀ ਹੀ ਬੋਲਦੇ ਹਨ ਪੰਜਾਬ ਅਤੇ ਹਰ ਬੱਚੇ ਨੂੰ ਪੰਜਾਬੀ ਆਉਂਦੀ ਹੈ ਸਾਡੇ ਜਿਹੜੇ ਮਤਲਬ ਕਿ ਐਨ ਜੀ ਓ 'ਚ ਜਿਹੜੇ ਸਾਡੇ ਨਾਲ ਕੰਮ ਕਰਦੇ ਹੈ ਉਹ ਵੀ ਪੰਜਾਬੀ 'ਚ ਹੀ ਗੱਲਬਾਤ ਕਰਦੇ ਹੈ ਅਤੇ ਪੰਜਾਬੀ ਇੱਕ ਮਹੱਤਵ ਪੰਜਾਬੀ ਨੂੰ ਅਸੀਂ ਰ ਮਤਲਬ ਕਿ ਇੱਕ ਪਰਫੈਕਟ ਪੰਜਾਬੀ ਕਹਿੰਦੇ ਹਾਂ ਹੋਰ ਮਤਲਬ ਕਿ ਸਕੂਲਾਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਇੰਗਲਿਸ਼ ਸਕੂਲ ਹੁੰਦੇ ਆ ਪਰ ਉੱਥੇ ਪੰਜਾਬੀ ਨਹੀਂ ਲੱਗੀ ਹੁੰਦੀ ਪਰ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਜ਼ਰੂਰੀ ਹੈ ਹਰ ਸਕੂਲ 'ਚ ਬੱਚਿਆਂ ਨੂੰ ਵੀ ਉਹ ਕਹਿੰਦੇ ਆ ਕਿ ਪੰਜਾਬੀ ਨਹੀਂ ਬੋ ਪੰਜਾਬੀ ਨਹੀਂ ਬੋਲਣੀ ਹਿੰਦੀ ਜਾਂ ਇੰਗਲਿਸ਼ ਬੋਲੋ ਪਰ ਨਹੀਂ ਬੱਚਿਆਂ ਨੂੰ ਪੰਜਾਬੀ ਜ਼ਰੂਰੀ ਹੈ ਅੱ ਅੱਜ ਕੱਲ੍ਹ ਦੇ ਪਲੇਵੇਅ ਕੋਈ ਵੀ ਸਕੂਲ ਹੈ ਉਹਨਾਂ ਦੇ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ ਪਰ ਪੰਜਾਬੀ ਬੋਲਣੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਕਈ ਗੱਲਾਂ